ਮੇਰਾ ਨਾਮ ਰਵਿੰਦਰ ਸਿੰਘ ਹੈ ਮੈਂ ਦਸਵੀਂ ਪਿੰਡ ਦੇ ਸਕੂਲ ਸਰਕਾਰੀ ਹਾਈ ਸਕੂਲ ਹੰਡਿਆਇਆ ਤੋਂ ਕੀਤੀ ਹੈ ਪਲੱਸ ਟੂ ਮੈਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਤੋਂ ਕੀਤੀ ਹੈ ਬੀਏ ਮੈਂ ਯੂਨੀਵਰਸਿਟੀ ਕਾਲਜ ਬਰਨਾਲਾ ਤੋਂ ਕੀਤੀ ਹੈ ਗ੍ਰੈਜੂਏਸ਼ਨ ਮੈਂ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਅਤੇ ਮੈਂ ਆਪਣੇ ਸਾਰੇ ਯੋਗਤਾ ਅਪਡੇਟ ਕਰਨਾ ਚਾਹੁੰਦਾ ਹਾਂ ਪੀਐਮਕੇ ਵ ਵੀ ਬੀ ਵਾਈ 'ਤੇ ਤਾਂ ਕਿ ਮੈਨੂੰ ਕੋਈ ਕੌਸ਼ਲ ਸਿਖਾਇਆ ਜਾਵੇ ਮੈਂ ਆਪਣਾ ਖੁਦ ਦਾ ਰੁਜ਼ਗਾਰ ਚਲਾ ਸਕਾਂ ਪੀਐਮਕੇਵਾਈ ਦਾ ਪੂਰਾ ਨਾਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਹੈ ਇਹ ਪ੍ਰੋਗਰਾਮ ਐਮਐਸਡੀਈ ਦੁਆਰਾ ਚਲਾਇਆ ਗਿਆ ਹੈ ਇਹ ਭਾਰਤੀ ਨੌਜਵਾਨਾਂ ਨੂੰ ਉਦਯੋਗਾਂ ਪ੍ਰਤੀ ਆਕਰਸ਼ਿਤ ਕਰਨ ਲਈ ਤਾਂ ਕਿ ਇਹ ਉਹ ਆਪਣਾ ਖੁਦ ਦਾ ਰੁਜ਼ਗਾਰ ਚਲਾ ਸਕਣ ਇਸ ਵਿੱਚ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਕੌਸ਼ਲ ਸਿਖਾਏ ਜਾਂਦੇ ਹਨ ਇਹ ਥੋੜ੍ਹੇ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਇਸ ਸਕੀਮ ਵਿੱਚ ਆਪਣੀ ਵਿਦਿਅਕ ਯੋਗਤਾ ਅਪਡੇਟ ਕਰਨ ਲਈ ਸਭ ਤੋਂ ਪਹਿਲਾਂ ਪੀਐਮਕੇਵਾਈਵੀਵਾਈ ਦੀ ਵੈਬਸਾਈਟ 'ਤੇ ਜਾਵਾਂਗੇ ਫਿਰ ਨੇੜੇ ਦੇ ਪੀਐਮਕੇਵੀਵਾਈ ਟਰੇਨਿੰਗ ਸੈਂਟਰ ਦੀ ਤਲਾਸ਼ ਕਰਾਂਗੇ ਇਸ ਤੋਂ ਬਾਅਦ ਆਪਣੀ ਇੱਛਾ ਅਨੁਸਾਰ ਕੋਰਸ ਚੁਣਾਂਗੇ ਫਿਰ ਟ੍ਰੇਨਿੰਗ ਸੈਂਟਰ ਵਿੱਚ ਰਜਿਸਟਰ ਕਰਾਂਗੇ ਪੋਰਟਲ ਉੱਪਰ ਆਪਣੀ ਡਿਟੇਲ ਭਰਾਂਗੇ ਇਸ ਤੋਂ ਬਾਅਦ ਟ੍ਰੇਨਿੰਗ ਖਤਮ ਕਰਨ ਦਾ ਸਰਟੀਫਿਕੇਟ ਪ੍ਰਾਪਤ ਕਰਾਂਗੇ ਧੰਨਵਾਦ ਮੈਂ ਆਪਣੇ ਮਾਂ ਪਿਓ ਦੀ ਸੱਚੇ ਮਨ ਨਾਲ ਸੇਵਾ ਕਰਨ ਲਈ ਅਤੇ ਰੁਜ਼ਗਾਰ ਦੇ ਕਾਬਲ ਹੋਣਾ ਚਾਹੁੰਦਾ ਹਾਂ ਤਾਂ ਕਿ ਮੈਂ ਦੋ ਪੈਸੇ ਕਮਾ ਕੇ ਮੈਂ ਆਪਣੇ ਮਾਤਾ ਪਿਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਾਂ ਉਹਨਾਂ ਦੇ ਬੁਢਾਪੇ ਦਾ ਇੱਕ ਸਹਾਰਾ ਬਣ ਸਕਾਂ ਤਾਂ ਕਿ ਉਹਨਾਂ ਨੂੰ ਵੀ ਇੱਕ ਸੁੱਖ ਦਾ ਸਾਹ ਮਿਲ ਸਕੇ ਤਾਂ ਕਿ ਮੈਂ